ਮੈਂ ਵਰਿੰਦਰ ਕੁਮਾਰ ਜਿਲ੍ਹਾ ਪਠਾਨਕੋਟ ਦਾ ਰਹਿਣ ਵਾਲਾ ਹਾਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਜ਼ਿਲ੍ਹੇ ਪਠਾਨਕੋਟ ਵਿਚ ਇੱਕ ਬਹੁਤ ਹੀ ਵੱਡੀ ਲਾਈਬਰੇਰੀ ਹੈ ਉਸ ਵਿੱਚ ਹਰ ਤਰ੍ਹਾਂ ਦੀਆਂ ਕਿਤਾਬਾਂ ਹਰ ਸਮੇਂ ਮੌਜੂਦ ਹੁੰਦੀਆਂ ਹਨ ਮੈਨੂੰ ਜਦੋਂ ਵੀ ਹਫ਼ਤੇ ਵਿੱਚ ਇੱਕ ਜਾਂ ਦੋ ਵਾਰ ਲਾਈਬਰੇਰੀ ਜਾਣ ਦਾ ਮੌਕਾ ਮਿਲਦਾ ਹੈ ਤਾਂ ਮੈਂ ਉੱਥੇ ਧਾਰਮਿਕ ਕਿਤਾਬਾਂ ਪੜ੍ਹਨ ਨੂੰ ਤਹਿਜੀਵ ਦਿੰਦਾ ਹਾਂ ਧਾਰਮਿਕ ਕਿਤਾਬਾਂ ਪੜ੍ਹ ਕੇ ਹੀ ਮੈਂ ਉਸ ਰੂਹਾਨੀਅਤ ਉਸ ਪਰਮਾਤਮਾ ਦੇ ਬਾਰੇ ਜਾਣਨ ਦਾ ਬਹੁਤ ਉਤਸੁਕ ਹਾਂ ਅਤੇ ਹਮੇਸ਼ਾ ਉਸ ਦੀ ਰਹਿਨੁਮਾਈ ਵਿੱਚ ਰਹਿਣਾ ਚਾਹੁੰਦਾ ਹਾਂ ਧੰਨਵਾਦ ਜੀ